ਭਾਰਤੀ ਮੀਡੀਆ ਬਹੁਤ ਹੀ ਵਧੀਆ ਹੈ ਪਰ ਜੇ ਤੁਸੀਂ ਮੇਰੇ ਐਕਸਪੀਰੰਸ ਸੁਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਜਿਹੜੀ ਆ ਸੁਧਾਰ ਕਰਨ ਦੀ ਬਹੁਤ ਹੀ ਲੋੜ ਹੈ ਕਈ ਵਾਰ ਕੀ ਹੁੰਦਾ ਕਿ ਜਿੱਦਾਂ ਕਿ ਨਿਊਜ਼ ਚੈਨਲਾਂ 'ਤੇ ਖ਼ਬਰਾਂ ਆਉਂਦੀਆਂ ਹੈ ਉਹ ਕੀ ਕਰਦੇ ਹੈ ਕਿ ਇੱਕ ਛੋਟੀ ਜਿਹੀ ਖ਼ਬਰ ਨੂੰ ਇੰਨਾ ਵਧਾ ਚੜ੍ਹਾ ਕੇ ਦੱਸ ਦਿੰਦੀ ਹੈ ਕਿ ਜਿਹੜੀਆਂ ਮੇਨ ਖ਼ਬਰਾਂ ਉਹ ਦੱਸਦੇ ਨਹੀਂ ਹੈ ਪੂਰਾ ਪੂਰਾ ਦਿਨ ਬਸ ਉਹ ਹੀ ਖ਼ਬਰਾਂ ਚੱਲੀਆਂ ਰਹਿੰਦੀਆਂ ਹੈ ਜਿਵੇਂ ਕਿ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਅੰਬਾਨੀ ਦੇ ਬੇਟੇ ਦੀ ਮੈਰਿਜ ਹੋਈ ਸੀ ਅਤੇ ਉਹਨਾਂ ਨੇ ਮਤਲਬ ਉਹ ਇੰਨਾ ਜ਼ਿਆਦਾ ਉਹਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਪੂਰਾ ਪੂਰਾ ਦਿਨ ਸਾਰੇ ਨਿਊਜ਼ ਚੈਨਲਾਂ 'ਤੇ ਬਸ ਉਹਦੀਆਂ ਸੀ ਖ਼ਬਰਾਂ ਚੱਲੀਆਂ ਰਹਿੰਦੀਆਂ ਸੀ ਕੁਛ ਵੀ ਮਤਲਬ ਜਿਹੜੀਆਂ ਬਾਕੀ ਇੰਪੋਰਟੈਂਟ ਸੀ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਹਾਂ ਕਈ ਵਾਰ ਐ ਇੱਦਾਂ ਹੁੰਦਾ ਹੈ ਕਿ ਜਿਹੜੀਆਂ ਖ਼ਬਰਾਂ ਉਹ ਸਹੀ ਤੱਤ ਦਿਖਾਉਂਦੀਆਂ ਹੈ ਪਰ ਕਈ ਵਾਰ ਛੋਟੀ ਜਿਹੀ ਨਿਊਜ਼ ਨੂੰ ਬੜਾ ਹੀ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਮੈਂ ਮੈਚ ਨਿਊਜ਼ ਚੈਨਲ ਆਜ ਤੱਕ ਤੋਂ ਹੀ ਖਬਰਾਂ ਸੁਣਦੀ ਹਾਂ ਕਿਉਂਕਿ ਉਹ ਬਹੁਤ ਹੀ ਵਧੀਆ ਉੱਥੇ ਜਿਹੜੀਆਂ ਉਹ ਰੈਲੇਵੈਂਟ ਖ਼ਬਰਾਂ ਦਿਖਾਈਆਂ ਜਾਂਦੀਆਂ ਹੈ ਡੇਲੀ ਉਹਦੇ ਵਿੱਚ ਐਡਵਰਟਾਈਜਮੈਂਟ ਬਹੁਤ ਹੀ ਘੱਟ ਆਉਂਦੀ ਹੈ ਅਤੇ ਮੈਂ ਸਾਡੀ ਜਿਹੜੀਆਂ ਹੈ ਗੁਰਦਾਸਪੁਰ ਦੀਆਂ ਲੋਕਲ ਖ਼ਬਰਾਂ ਜਿਹੜੀਆਂ ਉਹ ਸੁਣਦੀ ਹਾਂ ਕਿਉਂਕਿ ਉਹਦੇ ਵਿੱਚ ਸਾਨੂੰ ਜਿਹੜੇ ਸਾਡੇ ਆਸ ਪਾਸ ਕੀ ਹੋ ਰਿਹਾ ਉਹਦਾ ਪਤਾ ਚੱਲ ਜਾਂਦਾ ਸਭ ਤੋਂ ਜ਼ਿਆਦਾ ਜਿਹੜੀ ਮੈਂ ਅਖ਼ਬਾਰ ਪੜ੍ਹਦੀ ਹਾਂ ਉਹ ਅਜੀਤ ਹੈ ਕਿਉਂਕਿ ਉਹਦੇ ਵਿੱਚ ਬਹੁਤ ਹੀ ਕਲੀਅਰ ਕੱਟ ਲਿਖਿਆ ਹੁੰਦਾ ਕਿ ਕੀ ਹੋ ਰਿਹਾ ਇੱਥੇ ਕੀ ਨਹੀਂ ਧੰਨਵਾਦ